ਹੈਲੋ ਸਤਿ ਸ਼੍ਰੀ ਅਕਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਦਿਨ ਵਿੱਚ ਖ਼ਬਰਾਂ ਮੈਂ ਹਰ ਰੋਜ਼ ਸੁਣਦੀ ਹਾਂ ਹਰ ਰੋਜ਼ ਪੜ੍ਹਦੀ ਹਾਂ ਪੜ੍ਹਨ ਦੇ ਲਈ ਮੈਂ ਨਿਊਜ਼ ਪੇਪਰ ਯੂਜ ਕਰਦੀ ਹਾਂ ਅਤੇ ਦੇਖਣ ਦੇ ਵਿੱਚ ਮੈਂ ਟੀ ਵੀ ਤੋਂ ਹੀ ਆਪਣੀਆਂ ਨਿਊਜ਼ ਪੇਪਰ ਦੇਖਦੀ ਹਾਂ ਅਤੇ ਜਿਹੜੀਆਂ ਖ਼ਬਰਾਂ ਹੈ ਉਹ ਕਾਫ਼ੀ ਤਰ੍ਹਾਂ ਦੀ ਦੀਆਂ ਹੁੰਦੀਆਂ ਨੇ ਖੇਡਾਂ ਦੀ ਮਨੋਰੰਜਨ ਦੀ ਵਪਾਰ ਦੀ ਅਪਰਾਧ ਦੀ ਵਿਗਿਆਨ ਦੀ ਸਿੱਖਿਆ ਦੀ ਰਾਜਨੀਤੀ ਦੀ ਪਰ ਹੁਣ ਕਰੰਟਲੀ ਕੀ ਹੈ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨੀ ਹੈ ਤਾਂ ਜਿਹੜੀਆਂ ਚੋਣਾਂ ਹੈ ਉਹ ਇੱਕ ਜੂਨ ਤੋਂ ਪੈ ਰਹੀਆਂ ਨੇ ਅਤੇ ਚਾਰ ਤਰੀਕ ਨੂੰ ਉਨ੍ਹਾਂ ਦੀ ਪੋਲਿੰਗ ਹੋਣੀ ਹੈ ਅਤੇ ਇਸ ਕਰਕੇ ਮੈਂ ਰਾਜਨੀਤੀ ਦੀਆਂ ਖ਼ਬਰਾਂ ਦੇਖ ਰਹੀ ਹਾਂ ਕਿਉਂਕਿ ਜਿਹੜਾ ਸਾਡਾ ਫੈਸਲਾ ਹੈ ਨਵੀਂ ਸਰਕਾਰ ਨੂੰ ਸੁ ਚੁਣਨ ਦਾ ਉਹ ਆਉਣ ਵਾਲਾ ਹੈ ਅਤੇ ਇਸ ਕਰਕੇ ਮੈਂ ਰਾਜਨੀਤੀ ਦੀਆਂ ਖ਼ਬਰਾਂ ਦੇਖ ਰਉ ਹਾਂ ਅਤੇ ਮੈਨੂੰ ਖ਼ਬਰਾਂ ਦੇਖਣੀਆਂ ਬਹੁਤ ਪਸੰਦ ਹੈ ਅਤੇ ਸਿੱਖਿਆ ਦੇ ਅਧਾਰ 'ਤੇ ਵੀ ਦੇਖਿਆ ਜਾਂਦਾ ਹੈ ਕੇ ਕੀ ਗੌਰਮਿੰਟ ਦੀ ਨਵੀਂ ਪੋਲਿਸੀ ਆ ਰਹੀ ਹੈ ਜਾਂ ਕਿ ਪਹਿਲਾਂ ਕੀ ਸੀ ਕੀ ਚੇਂਜ ਕੀਤਾ ਗਿਆ ਉਹਦੇ ਵਿੱਚ ਅਤੇ ਇਸ ਤੋਂ ਪਹਿਲਾਂ ਕੀ ਹੈ ਕਿ ਜਿਹੜਾ ਪੀ ਐੱਚ ਡੀ ਹੈ ਉਹ ਮਾਸਟਰਸ ਤੋਂ ਬਾਅਦ ਹੀ ਕੀਤੀ ਜਾਂਦੀ ਸੀ ਪਰ ਹੁਣ ਦੀ ਸਿੱਖਿਆ ਦੇ ਵਿੱਚ ਇਹਨਾਂ ਨੇ ਕੀਤਾ ਹੈ ਕਿ ਬੈਚਲੁਰ ਤੋਂ ਬਾਅਦ ਵੀ ਜਿਹੜਾ ਬੱਚਾ ਹੈ ਬੀਟੈੱਕ ਵਾਲਾ ਹੈ ਉਹ ਕੀ ਹੈ ਪੀ ਐੱਚ ਡੀ ਦੇ ਵਿੱਚ ਇਨਰੋਲ ਹੋ ਸਕਦਾ ਹੈ ਤਾਂ ਮੈਂ ਹਰ ਤਰ੍ਹਾਂ ਦੀਆਂ ਖ਼ਬਰਾਂ ਦੇਖਦੀ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ